ਮੇਰੇ ਨੇੜਲੇ ਇਲਾਕਿਆਂ ਵਿੱਚ ਬਹੁਤ ਸਾਰੇ ਹਸਪਤਾਲ ਹਨ ਜਿਵੇਂ ਕਿ ਮਹਿਤਾ ਹੋਸਪਿਟਲ ਕੋਸ਼ਲ ਹੋਸਪਿਟਲ ਅਬੋਲੋ ਹੋਸਪਿਟਲਸ ਇਹ ਸਾਰੇ ਪ੍ਰਾਈਵੇਟ ਹਸਪਤਾਲ ਹਨ ਇਹ ਇਹਨਾਂ ਤੱਕ ਪਹੁੰਚਣ ਲਈ ਸਾਡੇ ਪਿੰਡ ਵਿੱਚ ਕੋਈ ਜ਼ਿਆਦਾ ਸੁਵਿਧਾ ਤਾਂ ਹੈ ਨਹੀਂ ਕਿਉਂਕਿ ਇੱਥੇ ਬੱਸਾਂ ਦੀ ਬਹੁਤ ਹੀ ਘੱਟ ਸੁਵਿਧਾ ਹੈ ਬੱਸਾਂ ਟਾਈਮ 'ਤੇ ਨਹੀਂ ਆਉਂਦੀਆਂ ਹਨ ਅਤੇ ਸੜਕਾਂ ਵੀ ਟੁੱਟੀਆਂ ਹੋਈਆਂ ਹਨ ਤਾਂ ਇਹ ਸਾਨੂੰ ਦੂਰ ਵੀ ਪੈ ਜਾਂਦੇ ਹਨ ਅਤੇ ਜਾਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਮੈਂ ਇਹ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡੇ ਨੇੜਲੇ ਇਲਾਕਿਆਂ ਵਿੱਚ ਅਤੇ ਸਾਡੇ ਇਲਾਕੇ ਵਿੱਚ ਸਰਕਾਰੀ ਹਸਪਤਾਲ ਖੁੱਲ੍ਹਵਾਏ ਜਾਣ ਜਿਨ੍ਹਾਂ ਵਿੱਚ ਸਕੀਮਾਂ ਵੀ ਚਲਾਈਆਂ ਜਾਣ ਅਤੇ ਬਹੁਤ ਸਾਰੀਆਂ ਮਸ਼ੀਨਾਂ ਅਤੇ ਬਹੁਤ ਸਾਰੇ ਡੋਕਟਰ ਵੀ ਰੱਖੇ ਜਾਣ